ਅੱਜ ਐਤਵਾਰ ਦਾ ਦਿਨ ਹੈ ਮੇਰਾ ਦੋਸਤ ਮੈਨੂੰ ਮਿਲਣ ਵਾਸਤੇ ਆਇਆ ਹੈ ਮੈਂ ਅਤੇ ਮੇਰੇ ਦੋਸਤ ਨੇ ਅੱਜ ਘਰ ਦੇ ਵਿੱਚ ਬਾਹਰ ਤੋਂ ਖਾਣਾ ਮੰਗਵਾ ਕੇ ਖਾਣ ਦਾ ਪ੍ਰੋਗਰਾਮ ਬਣਾਇਆ ਇਸ ਲਈ ਮੈਂ ਫਿਰ ਆਪਣੇ ਦੋਸਤ ਵਾਸਤੇ ਭਰਾਵਾਂ ਦੇ ਢਾਬੇ ਉੱਪਰ ਕਾਲ ਕਰਕੇ ਘਰ ਦੇ ਵਿੱਚ ਹੀ ਖਾਣਾ ਭੇਜਣ ਦੀ ਬੇਨਤੀ ਕੀਤੀ ਜਿਸ ਦੇ ਵਿੱਚ ਮੈਂ ਉਹਨਾਂ ਕੋਲੋਂ ਦਾਲ ਮੱਖਣੀ ਪਰੌਂਠੇ ਆਈਸਕ੍ਰੀਮ ਮਿਕਸ ਵੈਜੀਟੇਬਲ ਅਤੇ ਸਿੰਪਲ ਫੁਲਕੇ ਮੰਗਵਾਏ ਜਿ ਜਿਸ ਨੂੰ ਖਾਣ ਤੋਂ ਬਾਅਦ ਮੈਂ ਫਰੀ ਹੋ ਕੇ ਉਸ ਖਾਣੇ ਦਾ ਬਿੱਲ ਵੈਬਸਾਈਟ ਢਾਬੇ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਕਰ ਰਿਹਾ ਹਾਂ ਜਿਸ ਦੇ ਵਿੱਚ ਪੂਰੇ ਖਾਣੇ ਦਾ ਵੇਰਵਾ ਜਿਸ ਦੇ ਵਿੱਚ ਦਾਲ ਮੱਖਣੀ ਆਈਸਕ੍ਰੀਮ ਮਿਕਸ ਵੈਜ ਸਿੰਪਲ ਫੁਲਕਾ ਆਦਿ ਉਸ ਦੀ ਡਿਟੇਲ ਦੇ ਰਿਹਾ ਹਾਂ ਅਤੇ ਬਿਲ ਡਾਊਨਲੋਡ ਇਸ ਲਈ ਕਰ ਰਿਹਾ ਹਾਂ ਕਿਉਂਕਿ ਉਹ ਬਿੱਲ ਕੰਪਨੀ ਪੇਅ ਕਰ ਰਹੀ ਹੈ